ਮੇਰੇ ਨਾਲ਼ ਤਾਂ ਇੱਦਾਂ ਦੀ ਕੋਈ ਘਟਨਾ ਨਹੀਂ ਹੋਈ ਲੇਕਿਨ ਮੈਂ ਬਹੁਤ ਸਾਰੇ ਲੋਕਾਂ ਨੂੰ ਭ੍ਰਿਸ਼ਟਾਚਾਰ ਕਰਦੇ ਹੋਏ ਦੇਖਿਆ ਹੈ ਇਸ ਬਾਰੇ ਮੇਰਾ ਇਹ ਸੋਚਣਾ ਹੈ ਕਿ ਭ੍ਰਿਸ਼ਟਾਚਾਰ ਕਰਨ ਲਈ ਸਿਰਫ਼ ਅਫ਼ਸਰ ਹੀ ਜ਼ਿਮੇਵਾਰ ਨਹੀਂ ਹੈ ਬਟ ਲੋਕ ਵੀ ਓਨੇ ਹੀ ਜ਼ਿੰਮੇਵਾਰ ਨੇ ਕਿਉਂਕਿ ਕਈ ਵਾਰ ਲੋਕ ਆਪ ਹੀ ਵੱਧ ਚੜ੍ਹ ਕੇ ਕਹਿੰਦੇ ਨੇ ਕਿ ਸਰ ਕੁਝ ਲੈ ਦੇ ਕੇ ਮੇਰਾ ਕੰਮ ਕਰ ਦਿਓ ਜਿਵੇਂ ਕਿ ਰੋਜ਼ ਹੀ ਦੇਖਣ ਨੂੰ ਮਿਲਦਾ ਹੈ ਕਿ ਅਗਰ ਪੁਲਿਸ ਔਫਿਸਰ ਜੋ ਹੈ ਉਹ ਬੰਦੇ ਨੂੰ ਕੋਈ ਰੋਡ ਦਾ ਰੂਲ ਨਾ ਫੋਲੋ ਕਰਨ ਲਈ ਚਲਾਨ ਕਰਨ ਨੂੰ ਰੋਕਦਾ ਹੈ ਤਾਂ ਇਨਸਾਨ ਅੱਗਿਓਂ ਕਹਿੰਦਾ ਹੈ ਕਿ ਸਰ ਕੁਝ ਲੈ ਦੇ ਕੇ ਸਾਰ ਲਓ ਕਿਉਂ ਚਲਾਨ ਕਰਨਾ ਇੱਦਾਂ ਦੇ ਮੌਕਿਆਂ ਤੋਂ ਹੀ ਕਰਪਸ਼ਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਅੱਗੇ ਦਫ਼ਤਰਾਂ ਵਿੱਚ ਆਪਣਾ ਕੰਮ ਕਰਵਾਉਣ ਲਈ ਵੀ ਲੋਕੀਂ ਕਰਪਸ਼ਨ ਦਾ ਸਹਾਰਾ ਲੈਂਦੇ ਨੇ ਤਾਂ ਕਿ ਉਹਨਾਂ ਦਾ ਕੰਮ ਜਲਦੀ ਹੋ ਸਕੇ ਕਰਪਸ਼ਨ ਜੋ ਹੈ ਇਸ ਨੂੰ ਰੋਕਣ ਲਈ ਲੋਕਾਂ ਨੂੰ ਵੀ ਜੋ ਹੈ ਉਹ ਅਵੇਅਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਕਰਪਸ਼ਨ ਨੂੰ ਪਰਮੋਟ ਨਹੀਂ ਕਰਨਾ ਚਾਹੀਦਾ ਇਸ ਦੀ ਜਗ੍ਹਾ ਲੋਕਾਂ ਨੂੰ ਅਫ਼ਸਰ ਨੂੰ ਸਾਫ਼ ਹੀ ਮਨ੍ਹਾ ਕਰਨਾ ਚਾਹੀਦਾ ਹੈ ਕਿ ਸਰ ਨਹੀਂ ਅਸੀਂ ਜੋ ਹੈ ਉਹ ਲੈ ਦੇ ਕੇ ਆਪਣਾ ਕੰਮ ਨਹੀਂ ਕਰਨਾ ਹੈ ਅਗਰ ਥੋੜ੍ਹਾ ਬਹੁਤਾ ਟਾਈਮ ਜ਼ਿਆਦਾ ਲੱਗਦਾ ਹੈ ਤਾਂ ਸਹੀ ਬਟ ਪਰੋਪਰ ਇੱਕ ਕਾਨੂੰਨੀ ਤਰੀਕੇ ਨਾਲ਼ ਹੀ ਆਪਣਾ ਕੰਮ ਕਰਨਾ ਹੈ ਜੇਕਰ ਲੋਕੀ ਕਰਪਸ਼ਨ ਦੇ ਬਾਰੇ ਅਵੇਅਰ ਹੋਣ ਅਤੇ ਇਸ ਤਰ੍ਹਾਂ ਨਾਲ਼ ਆਪਣੇ ਕੰਮ ਨਾ ਕਰਵਾਉਣ ਸਮੇਂ ਬਚਾਉਣ ਦੇ ਚੱਕਰ ਵਿੱਚ ਤਾਂ ਕਰਪਸ਼ਨ ਨੂੰ ਰੋਕਿਆ ਵੀ ਜਾ ਸਕਦਾ ਹੈ